ਖਬਰਾਂ ਵਿੱਚ ਅਗਰ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਸਮਾਜਿਕ ਸੱਭਿਆਚਾਰਕ ਮੁੱਦਿਆਂ 'ਤੇ ਬਹੁਤ ਘੱਟ ਗੱਲ ਹੁੰਦੀ ਹੈ ਅਤੇ ਅੱਜ ਕੱਲ੍ਹ ਕਿਉਂਕਿ ਚੋਣਾਂ ਦਾ ਮੌਸਮ ਚੱਲੀ ਜਾਂਦਾ ਹੈ ਅਤੇ ਵਿਸ਼ੇਸ਼ਤਾ ਅੱਜ ਕੱਲ੍ਹ ਦੀਆਂ ਖਬਰਾਂ ਰਾਜਨੀਤੀ ਨਾਲ ਚੋਣਾਂ ਦੇ ਕੀ ਸਿੱਟੇ ਨਿਕਲਣੇ ਹੈ ਕਿਹੜੇ ਨੇਤਾ ਦੀ ਕੀ ਹਵਾ ਚੱਲ ਰਹੀ ਹੈ ਇਸ ਵਿਸ਼ੇ 'ਤੇ ਜ਼ਿਆਦਾਤਰ ਖਬਰਾਂ ਚੱਲ ਰਹੀਆਂ ਨੇ ਹਾਂ ਖਬਰਾਂ ਵਿੱਚ ਸੱਭਿਆਚਾਰਕ ਮੁੱਦਿਆਂ ਦੀ ਬਹੁਤ ਜ਼ਿਆਦਾ ਘਾਟ ਹੈ ਸਾਡਾ ਪਿਛੋਕੜ ਸਾਡਾ ਇਤਿਹਾਸ ਕੀ ਹੈ ਸਾਡੇ ਪੁਰਾਣੇ ਬਜ਼ੁਰਗਾਂ ਦੀ ਕੀ ਰਹਿਣੀ ਸਹਿਣੀ ਸੀ ਇਹਨਾਂ ਵਿਸ਼ਿਆਂ 'ਤੇ ਇਹ ਸੋਚ ਕੇ ਚੱਲੋ ਕਿ ਕੋਈ ਗੱਲ ਹੁੰਦੀ ਹੀ ਨਹੀਂ ਹੈ ਹਾਂ ਕੁਛ ਸਮਾਜਿਕ ਮੁੱਦੇ ਜ਼ਰੂਰ ਚੱਕੇ ਜਾਂਦੇ ਹੈ ਜਿਵੇਂ ਨਸ਼ੇ ਦੀ ਬਹੁਤਾਤ ਇਹ ਸਾਡੇ ਸਮਾਜ ਨੂੰ ਖਾ ਰਹੀ ਹੈ ਘੁਣ ਵਾਂਗੂੰ ਇਸ ਵਿਸ਼ੇ 'ਤੇ ਕਾਫੀ ਆਰਟੀਕਲ ਆਉਂਦੇ ਨੇ ਅਤੇ ਜਿਵੇਂ ਅਸ਼ਲੀਲਤਾ ਬਹੁਤ ਫੈਲ ਰਹੀ ਹੈ ਚਰਿੱਤਰ ਤੋਂ ਵਿਅਕਤੀ ਡਿੱਗ ਰਿਹਾ ਇਹਨਾਂ ਵਿਸ਼ਿਆਂ 'ਤੇ ਵੀ ਕੁਛ ਆਰਟੀਕਲ ਆਉਂਦੇ ਨੇ ਇਹ ਮੈਂ ਮੰਨ ਸਕਦਾ ਅਤੇ ਨਹੀਂ ਤਾਂ ਅੱਜ ਕੱਲ੍ਹ ਚੋਣਾਂ ਦੇ ਸੰਬੰਧਿਤ ਹੀ ਜ਼ਿਆਦਾ ਖਬਰਾਂ ਜੋ ਹਾਈਲਾਈਟ ਹੋ ਰਹੀਆਂ ਧੰਨਵਾਦ